ਇਹ ਇਹ ਸਾਡੀ ਪੰਜਾਬੀ ਭਾਸ਼ਾ ਵਰਲਡ ਵਿੱਚ ਸੱਤਵੇਂ ਨੰਬਰ ਤੋਂ ਹੈ ਅਤੇ ਗੁਰੂ ਪੀਰਾਂ ਦੀ ਵੀ ਭਾਸ਼ਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਹੜੇ ਸਾਡੇ ਉਹ ਵੀ ਪੰਜਾਬੀ ਭਾਸ਼ਾ 'ਚ ਛਪੇ ਹੋਏ ਹਨ